ਮੈਂ ਆਪਣੇ ਨੇੜਲੇ ਕਸਬਿਆਂ ਪਿੰਡਾਂ ਦਾ ਦੌਰਾ ਮਹੀਨੇ ਦੇ ਵਿੱਚ ਦੋ ਵਾਰ ਕਰਦਾ ਹਾਂ ਅਤੇ ਦੌਰੇ ਕਰਨ ਦਾ ਉਦੇਸ਼ ਦਫਤਰੀ ਕੰਮ ਲਈ ਹੈ ਧੰਨਵਾਦ ਥੈਂਕ ਯੂ